ਕਲਾ ਕਲਾ ਬੰਦੇ ਨੂੰ ਨਿਖਾਰ ਦਿੰਦੀ ਜਿਸ ਤਰ੍ਹਾਂ ਕਿ ਮੈਨੂੰ ਸ਼ੁਰੂ ਤੋਂ ਹੀ ਪੇਂਟਿੰਗ ਦਾ ਬਹੁਤ ਸ਼ੌਂਕ ਰਿਹਾ ਜਦੋਂ ਮੈਂ ਕੋਲੇਜ ਪੜ੍ਹਦੀ ਸੀ ਬੀਐਡ ਕਰਦੀ ਸੀ ਤਾਂ ਯੂਥ ਫੈਸਟੀਵਲ ਲਈ ਨਾ ਮੈਂ ਯੂਨੀਵਰਸਿਟੀ ਗਈ ਸੀ ਉਹਦੇ ਲਈ ਮੈਂ ਪਾਰਟੀਸਪੇਟ ਕੀਤਾ ਸੀ ਰੰਗੋਲੀ ਵਿੱਚ ਔਰ ਮੈਂ ਉੱਥੇ ਇੰਨਾਂ ਕੁ ਜ਼ਿਆਦਾ ਇਮਪਰੈਸ ਹੋਈ ਸੀ ਵਿਦਿਆਰਥੀਆਂ ਦੇ ਹੁਨਰ ਨੂੰ ਦੇਖ ਕੇ ਉਹਨਾਂ ਦੀ ਕਲਾ ਨੂੰ ਦੇਖ ਕੇ ਕਿ ਬੱਚਿਆਂ ਨੇ ਜੋ ਰੰਗੋਲੀ ਬਣਾਈ ਸੀ ਉਹ ਤਾਂ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਕਾਰਪੇਟ ਵਿਛਾਇਆ ਹੁੰਦਾ ਆਂ ਔਰ ਉੱਥੇ ਬਹੁਤ ਹੀ ਅਲੱਗ ਅਲੱਗ ਤਰ੍ਹਾਂ ਦੀ ਮੈਂ ਕਲਾ ਦੇਖੀ ਸੀ ਚਾਹੇ ਉਹ ਕੈਨੇਸ ਪੇਂਟਿੰਗ ਸੀ ਜਾਂ ਫਿਰ ਉਹ ਰੰਗੋਲੀ ਸੀ ਉੱਥੇ ਇੱਕ ਅਲੱਗ ਹੀ ਨਜ਼ਾਰਾ ਮੈਨੂੰ ਦੇਖਣ ਨੂੰ ਮਿਲਿਆ ਸੀਗਾ ਇੱਥੋਂ ਤੱਕ ਕਿ ਮੈਨੂੰ ਉਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਟਾਈਫਾਈਡ ਹੋਇਆ ਹੋਇਆ ਸੀ ਤਾਂ ਮੈਂ ਇੱਕ ਕਲਾ ਨੂੰ ਦੇਖਣ ਲਈ ਡੇਲ੍ਹੀ ਮੈਂ ਤਿੰਨ ਦਿਨ ਦਾ ਸੀ ਯੂਥ ਫੈਸਟੀਵਲ ਮੈਂ ਤਿੰਨ ਦਿਨ ਲਗਾਤਾਰ ਜਾਂਦੀ ਰਹੀ ਔਰ ਮੈਂ ਉੱਥੇ ਜਾ ਕੇ ਇੰ ਕਿ ਤੁਹਾਨੂੰ ਉਹ ਬਿਆਨ ਨਹੀਂ ਕਰ ਸਕਦੀ